ਹਾਂਜੀ ਮੈਂ ਬਿਲਕੁਲ ਸੋਚਦੀ ਹਾਂ ਕਿ ਇੱਕ ਜਿਹੜਾ ਸਿੱਖਿਅਤ ਵਿਅਕਤੀ ਆ ਉਹ ਚੰਗੇ ਵਿਵਹਾਰ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਗਾ ਕਿਉਂਕਿ ਜਦੋਂ ਜੇ ਕੋਈ ਵੀ ਵਿਅਕਤੀ ਸਿੱਖਿਆ ਪ੍ਰਾਪਤ ਕਰਦਾ ਸਕੂਲ ਦੇ ਵਿੱਚ ਜਾਂ ਕੋਲਜ ਦੇ ਵਿੱਚ ਤਾਂ ਉਹਨੂੰ ਸਿੱਖਿਆ ਪ੍ਰਾਪਤ ਕਰਨੀ ਇੱਕ ਅਨੁਸ਼ਾਸ਼ਨ ਦੇ ਵਿੱਚ ਹੀ ਰਹਿਣਾ ਪੈਂਦਾ ਕਿਉਂਕਿ ਹਰ ਜਿਹੜੇ ਇੰਸੀਚੀਊਟ ਆ ਕੋਈ ਵੀ ਉਹਦੇ ਆਪਣੇ ਕੁਝ ਕੁ ਸਿਧਾਂਤ ਹੁੰਦੇ ਨੇ ਜਿਹਨਾਂ ਦੀ ਪਾਲਣਾ ਇੱਕ ਵਿਅਕਤੀ ਨੂੰ ਕਰਨੀ ਪੈਂਦੀ ਹੈਗੀ ਅਤੇ ਉਹ ਸਿਧਾਂਤਾਂ ਦੇ ਵਿੱਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕਰਦਾ ਗਾ ਉਚੇਰੀ ਸਿੱਖਿਆ ਦੇ ਲਈ ਇੱਕ ਵਿਅਕਤੀ ਨੂੰ ਹੋਸਟਲ ਦੇ ਵਿੱਚ ਵੀ ਰਹਿਣਾ ਪੈਂਦਾ ਗਾ ਅਤੇ ਉੱਥੇ ਹੋਸਟਲ ਦੇ ਵਿੱਚ ਉਸ ਨੂੰ ਕਾਫ਼ੀ ਜ਼ਿਆਦਾ ਐਡਜਸਟਮੈਂਟ ਵੀ ਕਰਨੀਆਂ ਪੈਂਦੀਆਂ ਨੇ ਜਿੱਥੇ ਕਿ ਉਹ ਇੱਕ ਚੰਗਾ ਬਿਹੇਵੀਅਰ ਸਿੱਖਦਾ ਗਾ ਅਤੇ ਉੱਥੇ ਇੱਕ ਅਨੁਸ਼ਾਸ਼ਨ ਦੇ ਵਿੱਚ ਰਹਿ ਕੇ ਹੀ ਉਹ ਪੜ੍ਹਾਈ